ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਭਾਅ ਜੀ ਮੈਂ ਨਿਰਮਲ ਬੋਲ ਰਿਹਾ ਜੀ ਪ੍ਰੈਸ ਰਿਪੋਰਟਰ ਹਾਂਜੀ ਭਾਅ ਜੀ ਮੈਂ ਨੈ ਤੁਹਾਡੇ ਕੋਲੋਂ ਕੋਈ ਜਨਰਲ ਨੌਲੇਜ ਲੈਣੀ ਚਾਹੁੰਦਾ ਕਿ ਤੁਹਾਡੇ ਸ਼ਹਿਰ ਵਿੱਚ ਮਤਲਬ ਕਿਆ ਪ੍ਰੋਗਰੈਸ ਹੋ ਰਹੀ ਹੈ ਕਿਸੇ ਕੰਮ ਬਾਰੇ ਕੋਈ ਨਹੀਂ ਹੋ ਰਹੀ ਕਿਸੀ ਵੀ ਕੋਈ ਸਰਕਾਰ ਕਿਆ ਕਰਾ ਰਹੀ ਹੈ ਤੁਹਾਡੇ ਏਰੀਏ 'ਚ ਇਹਨਾਂ ਚੀਜ਼ਾਂ ਬਾਰੇ ਤੁਹਾਡੀ ਕਿਆ ਰਾਏ ਹੈ ਉਹ ਜਾਣਨੀ ਚਾਹੁੰਦਾ ਸਮੁੱਚਾ ਇਹ ਦੱਸ ਦਿਉ ਜੋ ਤੁਹਾਨੂੰ ਲੱਗ ਰਿਹਾ ਕਿ ਤੁਹਾਡੇ ਸ਼ਹਿਰ 'ਚ ਹੋ ਰਿਹਾ ਜਾਂ ਤੁਹਾਨੂੰ ਕੋਈ ਕਮੀ ਦਿਖ ਰਹੀ ਹੈ ਕਿ ਕਮੀ ਹੈ ਜਾਂ ਕੋਈ ਡਿਵੈਲਪਮੈਂਟ ਹੋ ਰਹੀ ਹੈ ਕਿਸੇ ਚੀਜ਼ 'ਚ ਅੱਛਾ ਜੀ